ਸਾਡੇ ਇਲਾਕੇ ਦੇ ਜਿਹੜੇ ਐਮ ਐਲ ਏ ਹਨ ਉਹਨਾਂ ਦਾ ਕੀ ਕਹਿੰਦੇ ਆ ਨਾਮ ਹੈ ਜੈਨ ਅਤੇ ਵੈਸੇ ਅਸੀਂ ਉਹਨਾਂ ਸਾਡੀ ਜਿਵੇਂ ਗੱਲਬਾਤ ਉਹਨਾਂ ਨਾਲ ਹੁੰਦੀ ਰਹਿੰਦੀ ਆ ਰੋਜ਼ ਹੀ ਸਾਡੇ ਮਹੱਲੇ ਵਿੱਚ ਗੇੜਾ ਮਾਰਦੇ ਰਹਿੰਦੇ ਹਨ ਉਹਨਾਂ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਸਹੂਲਤਾਂ ਮਿਲੀਆਂ ਨ ਹਨ ਆਪਣੇ ਸਾਰੇ ਮੁਹੱਲੇ ਵਿੱਚ ਪਹਿਲਾਂ ਜਿਵੇਂ ਸਾਡੇ ਮੁਹੱਲੇ ਵਿੱਚ ਸੀਵਰ ਦੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀ ਜਿਹਦੇ ਕਰਕੇ ਸੀਵਰ ਦਾ ਪਾਣੀ ਬਾਹਰ ਨਿਕਲਦਾ ਰਹਿੰਦਾ ਸੀ ਬਹੁਤ ਹੀ ਗੰਦਾ ਪਾਣੀ ਜਿਹਦੇ ਕਰਕੇ ਉੱਥੇ ਮੱਖਰ ਮੱਛਰ ਮੱਖੀ ਸਾਰਾ ਕੁਛ ਇਕੱਠਾ ਹੁੰਦਾ ਰਹਿੰਦਾ ਸੀਗਾ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਬਿਮਾਰੀਆਂ ਲੱਗਦੀਆਂ ਸੀਗੀਆਂ ਜਵਾਕਾਂ ਨੂੰ ਖੇਡਣ 'ਚ ਦਿੱਕਤ ਆਉਂਦੀ ਸੀ ਬਹੁਤ ਹੀ ਇਹੋ ਜਿਹੀਆਂ ਸੀਗੀਆਂ ਪਰ ਸਾਡੇ ਐਮ ਐਲ ਏ ਜਦੋਂ ਦੇ ਵੀ ਆਏ ਹਨ ਉਹਨਾਂ ਨੇ ਇਹ ਸਾਰੀ ਪ੍ਰੋਬਲਮ ਨੂੰ ਸਹੀ ਕਰ ਦਿੱਤਾ ਪੂਰਾ ਸੀਵਰ ਦੀ ਸਮੱਸਿਆ ਨੂੰ ਠੀਕ ਕਰ ਦਿੱਤਾ ਹੁਣ ਸਾਨੂੰ ਕੋਈ ਵੀ ਦਿੱਕਤ ਨਹੀਂ ਹੁੰਦੀ ਪਹਿਲਾਂ ਜਦੋਂ ਵੀ ਪਾਣੀ ਖੜ੍ਹਾ ਰਹਿੰਦਾ ਸੀ ਵਹੀਕਲ ਜਦੋਂ ਆਉਂਦੇ ਜਾਂਦੇ ਸੀ ਐਕਸੀਡੈਂਟ ਵਗੈਰਾ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਸੀ ਪਰ ਹੁਣ ਇਹੋ ਜਿਹਾ ਕੁਛ ਵੀ ਨਹੀਂ ਰਿਹਾ ਅਤੇ ਸਾਡੇ ਵੀ ਜਿਵੇਂ ਗਲੀ 'ਚੋਂ ਕਾਫੀ ਬਜ਼ੁਰਗ ਲੋਕ ਨੇ ਜਿਹਨਾਂ ਨੂੰ ਸੈਰ ਕਰਦੇ ਸਮੇਂ ਉਹਨਾਂ ਨੂੰ ਥਕਾਵਟ ਹੁੰਦੀ ਹੈ ਤਾਂ ਉਹਨਾਂ ਨੂੰ ਬੈਠਣ ਲਈ ਕੋਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਤਾਂ ਸਾਡੇ ਜਿਹੜੇ ਐਮ ਐਲ ਏ ਨੇ ਉਹਨਾਂ ਨੇ ਬੈਂਚ ਵਗੈਰਾ ਸਾਡੀ ਗਲੀ ਵਿੱਚ ਲਗਵਾ ਦਿੱਤੇ ਨੇ ਜਿਹਦੇ ਕਰਕੇ ਜਿਹੜੇ ਬਜ਼ੁਰਗ ਲੋਕ ਨੇ ਉਹ ਸ਼ਾਮ ਨੂੰ ਠੰਡੇ ਛਾਂ 'ਚ ਉੱਥੇ ਬਹਿ ਕੇ ਗੱਲਾਂ ਵਗੈਰਾ ਕਰਦੇ ਹਨ ਹੋਰ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਹਨ ਹੋਰ ਵੀ ਜ ਜਿਵੇਂ ਸਾਡੇ ਬਿਜਲੀ ਦੀ ਕਾਫੀ ਦਿੱਕਤ ਰਹਿੰਦੀ ਸੀਗੀ ਸਾਡੇ ਮੁਹੱਲੇ ਵਿੱਚ ਬਿਜਲੀ ਆਏ ਦਿਨ ਜਾਂਦੀ ਰਹਿੰਦੀ ਸੀ ਗਰਮੀਆਂ 'ਚ ਬਹੁਤ ਦਿੱਕਤ ਹੋ ਰਹੀ ਸੀ ਫਰਿੱਜ ਦਾ ਸਾਰਾ ਸਮਾਨ ਵਗੈਰਾ ਸਾਰਾ ਕੁਛ ਗਰਮ ਹੋ ਜਾਂਦਾ ਸੀਗਾ ਬਹੁਤ ਦਿੱਕਤ ਆ ਰਹੀ ਸੀਗੀ ਪਰ ਸਾਡੇ ਐਮ ਐਲ ਏ ਨੇ ਸਾਰੇ ਟਰਾਂਸਫਾਰਮ ਵਗੈਰਾ ਸਾਰਾ ਕੁਛ ਲਗਵਾ ਦਿੱਤਾ ਜਿਹਦੇ ਕਰਕੇ ਸਾਨੂੰ ਹੁਣ ਬਿਜਲੀ ਦੀ ਤਾਂ ਕੋਈ ਦਿੱਕਤ ਆਉਂਦੀ ਨਹੀਂ ਹੈ ਸ ਪ੍ਰੋਪਰ ਸਾਰੇ ਘਰ ਬਿਜਲੀ ਸਪਲਾਈ ਹੁੰਦੀ ਹੈ ਸਾਡੇ ਘਰ ਵਾਟਰ ਪਾਣੀ ਦੀ ਸਮੱਸਿਆ ਵੀ ਕਾਫੀ ਆਉਂਦੀ ਸੀ ਵੀ ਪਾਣੀ ਹੈ ਨਾ ਟਾਈਮ 'ਤੇ ਨਹੀਂ ਆਉਂਦਾ ਸੀਗਾ ਪਰ ਹੁਣ ਇਹਨਾਂ ਨੇ ਗਰੁੱਪ ਬਣਾ ਲਏ ਨੇ ਵੀ ਕਿੰਨੇ ਵਜੇ ਪਾਣੀ ਪਾਇਆ ਜਾਵੇਗਾ ਅਤੇ ਕਿੰਨੇ ਵਜੇ ਆਵੇਗਾ ਪਾਣੀ ਪਹਿਲਾਂ ਪਾਣੀ ਗੰਦਾ ਆਉਂਦਾ ਸੀ ਪਰ ਹੁਣ ਪਾਣੀ ਕਾਫੀ ਸ਼ੁੱਧ ਆਉਣ ਲੱਗ ਗਿਆ ਜਿਹਦੇ ਕਰਕੇ ਹੁਣ ਸਾਡਾ ਮਹੱਲਾ ਕਾਫੀ ਸਾਫ਼ ਸੁਥਰਾ ਕਾਫੀ ਵਧੀਆ ਬਣ ਚੁੱਕਿਆ ਸਾਡੇ ਮਹੱਲੇ ਦੀ ਰੋਜ਼ ਸਫਾਈ ਵੀ ਹੁੰਦੀ ਹੈ ਸਾਰੇ ਕਰਮਚਾਰੀ ਰੋਜ਼ ਕੂੜਾ ਲੈਣ ਵੀ ਆਉਂਦੇ ਹਨ ਪ੍ਰੋਪਰ ਟਾਈਮ 'ਤੇ ਸਾਰਾ ਕੁਛ ਹੁੰਦਾ ਅਤੇ ਸਾਡੇ ਐਮ ਐਲ ਏ ਜੀ ਬਹੁਤ ਵਧੀਆ ਹਨ